ਮੈਨੂੰ ਨਾ ਇਡਲੀ ਬਣਾਉਣ ਦਾ ਬਹੁਤ ਜ਼ਿਆਦਾ ਸ਼ੌਕ ਸੀ ਅਤੇ ਮੈਨੂੰ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਹੈ ਬਟ ਮੈਨੂੰ ਉਹ ਬਣਾਉਣੀ ਨਹੀਂ ਆਉਂਦੀ ਸੀ ਇਸ ਕਰਕੇ ਮੈਂ ਯੂਟਿਊਬ 'ਤੇ ਇੱਕ ਚੈਨਲ ਗਰਿਮਾ ਸਪਰਾਈਡ ਫੋਲੋ ਕੀਤਾ ਅਤੇ ਮੈਂ ਉਹਨਾਂ ਦੀ ਰੈਸਿਪੀ ਦੇਖੀ ਬਿਕੋਜ਼ ਉਹ ਬਹੁਤ ਹੀ ਆਸਾਨ ਤਰੀਕੇ ਦੇ ਨਾਲ਼ ਖਾਣ ਵਾਲੀਆਂ ਚੀਜ਼ਾਂ ਬਣਾਉਣਾ ਦੱਸਦੇ ਆ ਅਤੇ ਬਣਾ ਬਣਾਉਂਦੇ ਆ ਸੋ ਸਭ ਤੋਂ ਪਹਿਲਾਂ ਮੈਂ ਇਡਲੀ ਹੀ ਬਣਾਉਣ ਦੀ ਕੋਸ਼ਿਸ਼ ਕੀਤੀ ਉਹਦੇ ਲਈ ਉਸ ਚੈਨਲ ਦੇ ਅਕੋਡਿੰਗਲੀ ਮੈਨੂੰ ਰਾਤ ਨੂੰ ਹੀ ਦਾਲ ਅਤੇ ਚਾਵਲ ਭਿਉਂ ਕੇ ਰੱਖਣੇ ਪੈਣੇ ਸੀ ਅਤੇ ਚ ਸਵੇਰੇ ਉਹਨੂੰ ਮੈਂ ਗ੍ਰਾਇੰਡ ਕਰ ਲਿਆ ਅਤੇ ਗ੍ਰਾਇੰਡ ਕਰਨ ਤੋਂ ਬਾਅਦ ਫਿਰ ਤੋਂ ਉਸਨੂੰ ਬਾਰਾਂ ਘੰਟੇ ਦੇ ਲਈ ਬਣਾ ਕੇ ਰੱਖਣਾ ਪਿਆ ਢੱਕ ਕੇ ਤਾਂ ਕਿ ਉਹ ਇੱਕ ਤਰ੍ਹਾਂ ਨਾਲ਼ ਉਹਦੀ ਫਰਮੈਂਟੇਸ਼ਨ ਹੋ ਜਾਵੇ ਤਾਂ ਬਾਰਾਂ ਘੰਟੇ ਰੱਖਣ ਤੋਂ ਬਾਅਦ ਫਿਰ ਮੈਂ ਉਹਨੂੰ ਇਡਲੀ ਸਟੈਂਡ ਦੇ ਵਿੱਚ ਗ੍ਰੀਸ ਕਰਕੇ ਉਹਦੇ ਵਿੱਚ ਉਹ ਬੈਟਰ ਜਿਹੜਾ ਸੀ ਉਹ ਪਾ ਦਿੱਤਾ ਅਤੇ ਉਹਨੂੰ ਮੈਂ ਫਿਰ ਪਾਣੀ ਦੇ ਉਬਲਦੇ ਪਾਣੀ ਦੇ ਵਿੱਚ ਉਦ ਉਹ ਸਟੈਂਡ ਨੂੰ ਟਿਕਾ ਦਿੱਤਾ ਪੰਦਰਾਂ ਮਿੰਟ ਦੇ ਵਿੱਚ ਉਹ ਇਡਲੀ ਜਿਹੜੀ ਆ ਭਾਫ਼ ਦੇ ਨਾਲ਼ ਪੱਕ ਕੇ ਤਿਆਰ ਹੋਣੀ ਸ਼ੁਰੂ ਹੋ ਜਾਂਦੀ ਆ ਅਤੇ ਫਿਰ ਮੈਂ ਉਹਨੂੰ ਇੱਕ ਨਾਈਫ਼ ਦੀ ਹੈਲਪ ਦੇ ਨਾਲ਼ ਚੈੱਕ ਕੀਤਾ ਤਾਂ ਉਹ ਬਣ ਕੇ ਤਿਆਰ ਹੋ ਚੁੱਕੀ ਸੀ ਅਤੇ ਇਸ ਤੋਂ ਬਿਨਾ ਇਡਲੀ ਦੇ ਨਾਲ਼ ਜਿਹੜੀ ਚਟਨੀ ਖਾਧੀ ਜਾਂਦੀ ਆ ਉਹ ਵੀ ਮੈਂ ਗਰਿਮਾ ਸਪਰਾਈਡ ਚੈਨਲ ਦੀ ਹੈਲਪ ਦੇ ਨਾਲ਼ ਹੀ ਬਣਾਈ ਅਤੇ ਉਹ ਵੀ ਉਹ ਬਣਾਉਣ ਤੋਂ ਬਾਅਦ ਮੈਨੂੰ ਲੱਗਿਆ ਕਿ ਮੈਂ ਸੱਚੀ ਵਿੱਚ ਵਧੀਆ ਜਿਹੜੀ ਆ ਚੀਜ਼ਾਂ ਬਣਾ ਸਕਦੀ ਹਾਂ ਅਤੇ ਬਾਕੀਆਂ ਨੂੰ ਵੀ ਬਣਾ ਕੇ ਖਿਲਾ ਸਕਦੀ ਹਾਂ ਕਿਉਂਕਿ ਉਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ਼ ਬਣਾਉਣਾ ਦੱਸਦੇ ਹਨ ਅਤੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ਼ ਜਿਹੜੀਆਂ ਆ ਆਪਾਂ ਘਰ ਦੇ ਵਿੱਚ ਹੀ ਇਹ ਸਾਰੀਆਂ ਚੀਜ਼ਾਂ ਬਣਾ ਕੇ ਖਾ ਸਕਦੇ ਹਾਂ ਅਤੇ ਬਾਕੀਆਂ ਨੂੰ ਵੀ ਖਿਲਾ ਸਕਦੇ ਹਾਂ